ਮੈਂ ਪੰਜਾਬ ਰਾਜ ਦੀ ਵਸਨੀਕ ਹਾਂ ਅਤੇ ਪੰਜਾਬ ਦੇ ਵਿੱਚ ਜਿਹੜਾ ਪਹਿਰਾਵਾ ਹੈ ਉਹ ਸਿੱਖਾਂ ਦਾ ਜਿਹੜਾ ਹੈਗਾ ਹੈ ਉਹ ਕੁੜਤਾ ਪਜਾਮਾ ਹੈ ਅਤੇ ਪੱਗ ਪਹਿਨਦੇ ਆ ਆਦਮੀ ਅਤੇ ਔਰਤਾਂ ਜਿਹੜੀਆਂ ਹੈਗੀਆਂ ਸਿੱਖਾਂ ਦੀਆਂ ਉਹ ਸੂਟ ਪਹਿਨਦੀਆਂ ਨੇ ਅਤੇ ਵਿਸ਼ੇਸ਼ ਮੌਕੇ ਜਿਹੜੇ ਖੁਸ਼ੀ ਦੇ ਮੌਕੇ ਨੇ ਉਹਦੇ 'ਤੇ ਉਹ ਫੁਲਕਾਰੀ ਵੀ ਲੈਂਦੀਆਂ ਨੇ ਗੂੜ੍ਹੇ ਰੰਗਾਂ ਦੀਆਂ ਜਿਵੇਂ ਵਿਆਹ ਦੇ ਮੌਕੇ ਇਸ ਤੋਂ ਇਲਾਵਾ ਜਿਹੜੇ ਮੁਸਲਿਮ ਲੋਕ ਨੇ ਉਹ ਪੰਜਾਬ ਦੇ ਵਿੱਚ ਔਰਤਾਂ ਬੁਰਕੇ ਪਹਿਨਦੀਆਂ ਨੇ ਅਤੇ ਜਿਹੜੇ ਆਦਮੀ ਨੇ ਮੁਸਲਿਮ ਧਰਮ ਨਾਲ ਸੰਬੰਧਿਤ ਉਹ ਪਠਾਨੀ ਸੂਟ ਪਹਿਨਦੇ ਨੇ ਅਤੇ ਹਿੰਦੂ ਭਾਈਚਾਰਾ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਧੋਤੀਆਂ ਪਹਿਨਦਾ ਆ ਅਤੇ ਉਨ੍ਹਾਂ ਦੀਆਂ ਜਿਹੜੀਆਂ ਹਿੰਦੂ ਭਾਈਚਾਰੇ ਦੀਆਂ ਔਰਤਾਂ ਨੇ ਉਹ ਜ਼ਿਆਦਾਤਰ ਸਾੜੀ ਪਹਿਨਦੀਆਂ ਨੇ ਇਸ ਤੋਂ ਇਲਾਵਾ ਜਿਹੜੇ ਗਹਿਣੇ ਨੇ ਗਹਿਣਿਆਂ ਦੇ ਵਿੱਚ ਪੰਜਾਬ ਦੇ ਵਿੱਚ ਆਦਮੀ ਹੈ ਜਿਹੜੇ ਉਹ ਕੈਂਠਾਂ ਕੜਾ ਅਤੇ ਮੁੰਦਰੀ ਪਹਿਨਦੇ ਨੇ ਵਿਸ਼ੇਸ਼ ਮੌਕਿਆਂ 'ਤੇ ਅਤੇ ਜਿਹੜੀਆਂ ਔਰਤਾਂ ਨੇ ਉਹ ਬਹੁਤ ਸਾਰੇ ਗਹਿਣੇ ਪਹਿਨਦੀਆਂ ਨੇ ਜਿਵੇਂ ਵਿਆਹਾਂ ਦੇ ਵਿੱਚ ਉਹ ਸੱਗੀ ਫੁੱਲ ਟਿੱਕਾ ਨੱਥ ਕਾਂਟੇ ਅਤੇ ਗਲ ਦੇ ਗਹਿਣੇ ਜਿਹੜੇ ਹੂਗਲੂ ਬੰਦ ਰਾਣੀ ਹਾਰ ਹੱਥਾਂ ਦੇ ਗਹਿਣਿਆਂ ਦੇ ਵਿੱਚ ਉਹ ਮੁੰਦਰੀਆਂ ਅਤੇ ਗਜ਼ਰੇ ਬਾਜ਼ੂ ਬੰਦ ਇਸ ਤੋਂ ਇਲਾਵਾ ਪੈਰਾਂ ਦੇ ਗਹਿਣਿਆਂ ਦੇ ਵਿੱਚ ਉਹ ਚੁਟਕੀਆਂ ਝਾਂਜਰਾਂ ਪੰਜੇਬਾਂ ਆਦਿ ਪਹਿਨਦੀਆਂ ਨੇ ਇਸ ਤਰਾਂ ਇਹ ਵੱਖਰੇ ਵੱਖਰੇ ਖੇਤਰ ਦੇ ਵਿੱਚ ਜਿਹੜੇ ਵੱਖਰੇ ਵੱਖਰੇ ਭਾਈਚਾਰੇ ਦੇ ਵਿੱਚ ਵੱਖਰੇ ਵੱਖਰੇ ਗਹਿਣੇ ਜਿਹੜੇ ਪਹਿਨੇ ਜਾਂਦੇ ਨੇ